ਮੇਰੀ ਰਾਜਨੀਤੀ ਦੇ ਵਿੱਚ ਕੋਈ ਬਹੁਤੀ ਦਿਲਚਸਪੀ ਤਾਂ ਨਹੀਂ ਹੈ ਅਤੇ ਨਾ ਹੀ ਮੈਂ ਕਦੇ ਰਾਜਨੀਤਿਕ ਮਾਮਲਿਆਂ ਵੱਲ ਬਹੁਤਾ ਧਿਆਨ ਦਿੱਤਾ ਹੈ ਹਾਂਜੀ ਪਰ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਬਹੁਤ ਅੱਛੇ ਕੰਮ ਕਰ ਰਹੀ ਹੈ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਵੀ ਕੀਤੇ ਪਟਿਆਲਾ ਸ਼ਾਹੀ ਸ਼ਹਿਰ ਹੈ ਰਾਜਿਆਂ ਦਾ ਸ਼ਹਿਰ ਹੈ ਇੱਥੇ ਕਾਂਗਰਸ ਵੀ ਆਈ ਅਕਾਲੀ ਦਲ ਵੀ ਜਾਂ ਫਿਰ ਹੁਣ ਆਪ ਦੀ ਸਰਕਾਰ ਹੈ ਤਾਂ ਜਿਵੇਂ ਬਹੁਤ ਸਾਰੇ ਸਰਕਾਰੀ ਦਫਤਰਾਂ ਦੇ ਵਿੱਚ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਬੜੇ ਚੰਗੇ ਤਰੀਕੇ ਦੇ ਨਾਲ ਸਰਕਾਰ ਦੁਆਰਾ ਕੰਮ ਕਰਵਾਏ ਜਾ ਰਹੇ ਨੇ ਬੱਚਿਆਂ ਨੂੰ ਵੀ ਕੁਝ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਹੁਣ ਮੈਰਿਜ ਸਰਟੀਫਿਕੇਟ ਬਣਵਾਉਣੇ ਨੇ ਚਾਹੇ ਕੋਈ ਪੁਰਾਣੀ ਹੀ ਮੈਰਿਜ ਹੋਈ ਹੋਵੇ ਤਾਂ ਘਰ ਤੱਕ ਆ ਕੇ ਇਹ ਸਹੂਲਤ ਜਿਹੜੀ ਹੈ ਮੁਹੱਈਆ ਕਰਵਾਈ ਗਈ ਹੈ